ਪੰਜ ਅਕਤੂਬਰ ਉੱਨੀ ਸੌ ਵੀਹ ਚੌਦ੍ਹਾਂ ਦਸੰਬਰ ਉੱਨੀ ਸੌ ਇਕਾਨਵੇਂ ਇੱਕ ਜਨਵਰੀ ਦੋ ਹਜ਼ਾਰ ਪੰਜ ਪੰਜ ਜੂਨ ਦੋ ਹਜ਼ਾਰ ਦਸ ਦਸ ਅਗਸਤ ਦੋ ਹਜ਼ਾਰ ਸਤਾਰ੍ਹਾਂ